ਮੈਂ ਨਵਾਂਸ਼ਹਿਰ ਦੀ ਰਹਿਣ ਵਾਲੀ ਹਾਂ ਰਹਿਣ ਵਾਲੀ ਹਾਂ ਇੱਥੇ ਦੀ ਚੈਈਟਿੰਗ ਚੈਰਿੰਗ ਚੈਰੀਟਿੰਗ ਜਾਂ ਭਾਈਚਾਰਾ ਸੰਸਥਾਵਾਂ ਹਨ ਹਨ ਇੱਥੇ ਦੇ ਲੋਕ ਬਹੁਤ ਹੀ ਵਧੀਆ ਹਨ ਕਿ ਉੱਥੇ ਜਾਂ ਕਿਸੇ ਵੀ ਕਿਸੇ ਨੂੰ ਵੀ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਤਾਂ ਉਹਨਾਂ ਨੂੰ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਇਸ ਨਾਲ ਇੱਥੇ ਹੀ ਸੰਭਾਲ ਸਾਂਭ ਸੰਭਾਲ ਕੀਤੀ ਕਰਨ ਲਈ ਇੱਥੇ ਲੈ ਕੇ ਆ ਸਕਦੇ ਹਨ ਆ ਲੈ ਕੇ ਸਕਦੇ ਹਨ ਕਈਆਂ ਨੂੰ ਤਾਂ ਇਲਾਜ਼ ਦੀ ਵੀ ਲੋੜ ਹੁੰਦੀ ਹੈ ਬਾਲ ਬੱਚਿਆਂ ਨੂੰ ਸਕੂਲ ਜਾਣ ਦੀ ਦਿੱਕਤ ਹੁੰਦੀ ਹੈ ਹੋਸਪੀਟਲਾਂ ਦੀ ਇਲਾਜ ਕਰਨ ਲਈ ਤੁਸੀਂ ਇੱਥੇ ਆ ਸਕਦੇ ਹਨ ਇੱਥੇ ਦੀਆਂ ਮੇਰੀ ਕਈ ਸਹੇਲੀਆਂ ਵੀ ਰਹਿੰਦੀਆਂ ਹਨ ਧੰਨਵਾਦ